ਹਾਂਜੀ ਸਰ ਭਾਰਤ ਟੈਕਸੀ ਤੋਂ ਬੋਲ ਰਹੇ ਹੋ ਹਾਂਜੀ ਸਰ ਮੈਂ ਨਾ ਕੱਲ੍ਹ ਨੋ ਨੋਇਡਾ ਜਾਣ ਵਾਸਤੇ ਤੁਹਾਡੀ ਕੈਬ ਬੁੱਕ ਕੀਤੀ ਸੀਗੀ ਅਤੇ ਡਰਾਈਵਰ ਨੂੰ ਮੈਂ ਇੱਕ ਹਜ਼ਾਰ ਰੁਪਈਆ ਕੈਸ਼ ਪੇਅ ਕੀਤਾ ਸੀਗਾ ਪਰ ਹੁਣ ਉਹ ਸਾਡਾ ਪ੍ਰੋਗਰਾਮ ਕੈਂਸਲ ਕਰ ਕੈਂਸਲ ਹੋ ਗਿਆ ਕਿਉਂਕਿ ਉਹ ਫੰਕਸ਼ਨ ਸਾਡਾ ਪੋਸਟਪੋਨ ਹੋ ਗਿਆ ਇਸ ਲਈ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਮੇਰਾ ਉਹ ਅਮਾਊਂਟ ਵਾਪਸ ਕਰ ਦਿਉ ਅਤੇ ਜਿਹੜੀ ਐਡਵਾਂਸ ਦੀ ਰਕਮ ਹੈਗੀ ਹੈ ਇੱਕ ਹਜ਼ਾਰ ਰੁਪਈਆ ਤੁਸੀਂ ਮੈਨੂੰ ਪੇਟੀਐੱਮ ਦੇ ਵਿੱਚ ਪਾ ਸਕਦੇ ਹੋ ਪੇਟੀਐੱਮ ਦੇ ਵਿੱਚ ਪਾ ਕੇ ਮੇਰੇ ਇਹ ਪੈਸੇ ਵਾਪਸ ਕਰ ਦਿਉ ਜਾਂ ਤੁਸੀਂ ਇਹਨੂੰ ਮੇਰੇ ਬੈਂਕ ਅਕਾਊਂਟ ਦੇ ਵਿੱਚ ਵੀ ਪਾ ਸਕਦੇ ਹੋ ਕਿਰਪਾ ਕਰਕੇ ਮੇਰੇ ਪੈਸੇ ਰਿਫੰਡ ਕਰ ਦਿਉ